ਹੈਲੋ ਉਪਾਸਨਾ ਕਿਵੇਂ ਓਂ ਠੀਕ ਠਾਕ ਮੈਂ ਵਧੀਆ ਠੀਕ ਠਾਕ ਹੋਰ ਮੈਂ ਹਾਂ ਵਧੀਆ ਠੀਕ ਠਾਕ ਕਰਦੇ ਤਾਂ ਕੁਛ ਨਹੀਂ ਬਸ ਗ੍ਰੈਜੂਏਸ਼ਨ ਕੰਪਲੀਟ ਹੋ ਗਈ ਆ ਤਾਂ ਹੁਣ ਸੋਚਦੇ ਹਾਂ ਕਿ ਕੁਛ ਮਤਲਬ ਅੱਗੇ ਕੁਛ ਨਵਾਂ ਕਰੀਏ ਹਾਂ ਅਤੇ ਤੁਸੀਂ ਕੰਮ ਹਜੇ ਤਾਂ ਕੋਈ ਨਹੀਂ ਦੇਖੋ ਅੱਗੇ ਸਟੱਡੀ ਤਾਂ ਕਰਨੀ ਨਹੀਂ ਕੋਈ ਬਿਜਨਸ ਹੀ ਸੋਚ ਰਹੇ ਸੀਗੇ ਕਿਵੇਂ ਦਾ ਮਤਲਬ ਇੱਕ ਤਾਂ ਮੈਨੂੰ ਇਹ ਹੈ ਕਿ ਕਿਸੇ ਜਿਵੇਂ ਵੱਖ ਵੱਖ ਬਹੁਤ ਸਾਰੇ ਵਰਾਇਟੀਜ ਨੇ ਆਪਾਂ ਜਿਵੇਂ ਫੂਡ ਦਾ ਕੰਮ ਵੀ ਕਰ ਸਕਦੇ ਹਾਂ ਜ ਜਾਂ ਫਿਰ ਬਿਊਟੀ ਪਾਰਲਰ ਦਾ ਕੋਸਮੈਟਿਕ ਦਾ ਕੋਈ ਸ਼ੋਪ ਹੈ ਕੋਈ ਮਤਲਬ ਕੋਈ ਵੀ ਕਿਸੇ ਵੀ ਫੀਲਡ ਦੇ ਵਿੱਚ ਕਰ ਸਕਦੇ ਹਾਂ ਕੰਮ ਪਰ ਉਸ ਤੋਂ ਪਹਿਲਾਂ ਨਾ ਇੰਟਰਸਟ ਵੀ ਹੋਣਾ ਉਸ ਚੀਜ਼ ਦੇ ਵਿੱਚ ਬਹੁਤ ਜ਼ਰੂਰੀ ਆ ਤਾਂ ਹਜੇ ਮੈਂ ਸੋਚ ਰਹੀ ਹਾਂ ਕਿ ਕਿਹੜੇ ਪਾਸੇ ਕੰਮ ਕਰਾਂ ਇੱਕ ਜੇ ਕੋਈ ਪਾਰਟਨਰ ਮਿਲ ਜੇ ਤਾਂ ਹੋਰ ਵੀ ਵਧੀਆ ਹਮ ਅੱਛਾ ਇਕੱਠੇ ਮਿਲ ਕੇ ਤੁਸੀਂ ਸੋਚ ਰਹੇ ਹੋ ਹਾਂ ਹਾਂ ਇਹ ਇਹ ਚੀਜ਼ ਕਾਫੀ ਵਧੀਆ ਹਾਂ ਹਾਂ ਇਹ ਚੀਜ਼ ਕਾਫੀ ਵਧੀਆ ਜੇ ਆਪਾਂ ਮਿਲ ਕੇ ਕਰ ਲਈ ਅੱਛਾ ਬੁਟੀਕ ਬੁਟੀਕ ਦੇ ਵਿੱਚ ਤਾਂ ਵੈਸੇ ਆਪਾਂ ਬਹੁਤ ਕੁਛ ਕਰ ਸਕਦੇ ਹਾਂ ਜਿਵੇਂ ਤੁਹਾਨੂੰ ਤਾਂ ਸਟੀਚਿੰਗ ਵੀ ਆਉਂਦੀ ਆ ਕੱਪੜਾ ਵਗੈਰਾ ਵੀ ਆਪਾਂ ਲੁਧਿਆਣੇ ਵਗੈਰਾ ਤੋਂ ਚੱਕ ਸਕਦੇ ਹਾਂ ਉੱਥੇ ਨੋਨ ਨੇ ਆਪਣੇ ਹੈਗੇ ਸਸਤੇ ਰੇਟ 'ਚ ਮਿਲ ਜਾ ਸਕਦਾ ਕਢਾਈਆਂ ਦੇ ਲਈ ਵਰਕਰ ਰੱਖ ਸਕਦੇ ਹਾਂ ਮੈਨੂੰ ਇਹ ਕਿ ਜਿਹੜਾ ਵੀ ਕਰਨਾ ਨਾ ਇੱਕ ਪੂਰਾ ਫੁੱਲ ਫਲੈਜਡ ਆਪਾਂ ਜਿਵੇਂ ਸਾਰਾ ਕੁਛ ਉਸ ਚੀਜ਼ ਦੇ ਵਿੱਚ ਵਰਾਇਟੀ ਆਪਾਂ ਪ੍ਰੋਵਾਈਡ ਕਰਵਾ ਦਈਏ ਅਤੇ ਤਾਂ ਕਿ ਜਿਹੜਾ ਕਸਟਮਰ ਆ ਉਹ ਫੁੱਲੀ ਸੈ ਸੈਟਿਸਫਾਈ ਹੋ ਸਕੇ ਹੈ ਨਾ ਅਤੇ ਹਮ ਹਾਂ ਹਾਂ ਹਾਂ ਹਾਂ ਹਾਂ ਹਾਂ ਵੈਸੇ ਬਾਹਰ ਵੈਸੇ ਬਾਹਰ ਵੀ ਇਹਦੀ ਕਾਫੀ ਜ਼ਿਆਦਾ ਡਿਮਾਂਡ ਆ ਬਾਹਰਲੇ ਦੇਸ਼ਾਂ ਦੇ ਵਿੱਚ ਤਾਂ ਆਪਾਂ ਉਹਨਾਂ ਨੂੰ ਵੀ ਸਪਲਾਈ ਕਰ ਸਕਦੇ ਹਾਂ ਤਾਂ ਮੈਨੂੰ ਐਂ ਲੱਗਦਾ ਕਿ ਮੈਂ ਜਾਂ ਬਾਕੀ ਸਾਰੀਆਂ ਆਪਸ਼ਨਾਂ ਨਾਲੋਂ ਆਪਾਂ ਨੂੰ ਬੁਟੀਕ ਜਿਹੜਾ ਬੈਟਰ ਰਹੇਗਾ ਹੈ ਨਾ ਹਾਂ ਹਾਂ ਬੈਠ ਕੇ ਥੋੜ੍ਹੀ ਗੱਲ ਹੋ ਸਕਦੀ ਹੈ ਵਧੀਆ ਆਪਾਂ ਬੈਠ ਕੇ ਕਿਸੇ ਦਿਨ ਮਿਲਦੇ ਹਾਂ ਗੱਲ ਕਰਦੇ ਆਰਾਮ ਦੇ ਨਾਲ ਸਾਰਾ ਅਜਿਹਾ ਬ ਬਣਾਉਂਦੇ ਹਾਂ ਕਿ ਕੀ ਬਜਟ ਹੈ ਇਸਦਾ ਠੀਕ ਆ ਚਲੋ ਠੀਕ ਹੈ ਫਿਰ ਜੀ ਹਾਂ ਠੀਕ ਹੈ ਸਤਿ ਸ਼੍ਰੀ ਅਕਾਲ